ਇੱਕ ਸਮੇਂ ਦੀ ਗੱਲ ਹੈ ਕਿ ਮੈਂ ਸ਼ਿਵ ਭੋਲੇ ਮਹਾਰਾਜ ਜੀ ਦੀ ਸਭ ਤੋਂ ਵੱਡੀ ਮੂਰਤੀ ਤਿਆਰ ਕੀਤੀ ਸੀ ਉਸ ਲਈ ਮੇਰਾ ਕਈ ਮਟੀਰੀਅਲ ਲੱਗਿਆ ਸੀ ਉਸ ਮੂਰਤੀ ਨੂੰ ਤਿਆਰ ਕਰਨ ਲਈ ਤਿੰਨ ਦਿਨ ਲੱਗ ਗਏ ਸੀ ਅਤੇ ਉਹ ਮੂਰਤੀ ਮੈਂ ਬੜੇ ਹੀ ਚੰਗੇ ਢੰਗ ਨਾਲ਼ ਤਿਆਰ ਕੀਤੀ ਸੀ ਸਭ ਤੋਂ ਪਹਿਲਾਂ ਮੈਨੂੰ ਚੀਕਣੀ ਮਿੱਟੀ ਲੈ ਕੇ ਆਉਣੀ ਪਈ ਉਸਨੂੰ ਭਿਉਂ ਕੇ ਰੱਖਣਾ ਪਿਆ ਫੇਰ ਮੈਂ ਉਸਦਾ ਆਕਾਰ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਟਾਇਮ ਲੱਗਿਆ ਉਸ ਮੂਰਤੀ ਨੂੰ ਤਿਆਰ ਕਰਨ ਲਈ ਬਹੁਤ ਸਮਾਂ ਲੱਗਿਆ ਸੀ ਅਤੇ ਉਹ ਸ਼ਿਵ ਭੋਲੇ ਦੀ ਮੂਰਤੀ ਅੱਜ ਵੀ ਮੰਦਰ ਵਿੱਚ ਪਈ ਹੈ